ਸਾਡਾ ਪਿੰਡ ਜਮਾਂ ਹੀ ਪੰਜਾਬ ਦੇ ਬੋਡਰ 'ਤੇ ਹੈ ਅਤੇ ਉਹ ਇੱਕ ਪਛੜਿਆ ਪਿੰਡ ਹੋਣ ਕਰਕੇ ਉੱਥੇ ਜਿਹੜੀ ਡਾਂਸ ਦੀ ਅਕੈਡਮੀ ਦੀ ਅਵੇਲੇਬਿਲਟੀ ਆ ਉਹ ਬਿਲਕੁਲ ਹੀ ਨਹੀਂ ਹੈ ਜਿ ਕ ਜਿਹਦੇ ਕਰਕੇ ਕਾਫੀ ਜਿਹੜੇ ਡਾਂਸਰਸ ਨੇ ਜਿਹੜੇ ਡਾਂਸ ਕਰਨਾ ਚਾਹੁੰਦੇ ਨੇ ਆਪਣਾ ਕਰੀਅਰ ਅੱਗੇ ਡਾਂਸਰ ਹੋਣ ਦੇ ਵਿੱਚ ਜਾਂ ਫਿਰ ਕੋਰੀਓਗ੍ਰਾਫਰ ਬਣਨ ਦੇ ਵਿੱਚ ਬਣਾਉਣਾ ਚਾਹੁੰਦੇ ਨੇ ਉਹਨੂੰ ਕਈ ਤਰ੍ਹਾਂ ਦੀਆਂ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈਂਦਾ ਜਿਵੇਂ ਕਦੇ ਕਦੇ ਉਹਨਾਂ ਦੇ ਸਾਧਨਾਂ ਦੀ ਘਾਟ ਹੋ ਜਾਂਦੀ ਹੈ ਉਹਨਾਂ ਨੂੰ ਉੱਥੇ ਪ੍ਰੋਪਰ ਕੋਚਿੰਗ ਨਹੀਂ ਦਿੱਤੀ ਜਾਂਦੀ ਅਤੇ ਨਾਲ ਹੀ ਨਾਲ ਜਿਹੜੀਆਂ ਸ਼ੋਸ਼ਲ ਇਨਕੁਐਲਿਟੀਸ ਨੇ ਲਾਈਕ ਉਹਨਾਂ ਨੂੰ ਜਿਹੜੇ ਸਾਡੇ ਨਾਈਬਰਸ ਨੇ ਜਾਂ ਫਿਰ ਜਿਹੜੀ ਸੋਸਾਇਟੀ ਆ ਉਹਨੂੰ ਲੱਗਦਾ ਹੈ ਕਿ ਇੱਕ ਡਾਂਸਰ ਬਣਨਾ ਇੱਕ ਚੰਗਾ ਕੋ ਕੋਰੀਓਗ੍ਰਾਫਰ ਬਣਨਾ ਕੋ ਚੰਗਾ ਕਰੀਅਰ ਨਹੀਂ ਹੈ ਤੁਹਾਨੂੰ ਸਿਰਫ਼ ਪੜ੍ਹਾਈ ਦੇ ਵਿੱਚ ਹੀ ਵਧੀਆ ਹੋਣਾ ਚਾਹੀਦਾ ਹੈ ਅਗਰ ਤੁਸੀਂ ਡਾਂਸ ਵਧੀਆ ਕਰ ਰਹੇ ਹੋ ਪੜ੍ਹਾਈ ਨਹੀਂ ਕਰ ਰਹੇ ਤਾਂ ਇਟ ਮੀਨਸ ਤੁਹਾਡਾ ਜਿਹੜਾ ਅ ਕਰੀਅਰ ਜਾਂ ਸਕਸੈਸ ਹੋਣ ਦਾ ਜਿਹੜਾ ਸੁਪਨਾ ਹੈ ਉਹ ਠੀਕ ਨਹੀਂ ਹੈ ਤੁਸੀਂ ਕਰੀਅਰ 'ਚ ਸਕਸੈਸ ਨਹੀਂ ਹੋ ਸਕਦੇ ਡਾਂਸ ਦੇ ਥਰੂ ਅਤੇ ਇਹ ਜਿਹੜਾ ਹੈਗਾ ਮੰਨਣਾ ਹੈਗਾ ਅਤੇ ਇਹ ਮੈਂ ਮੈਨੂੰ ਲੱਗਦਾ ਹੈ ਕਿ ਸਾਧਨਾਂ ਦੀ ਘਾਟ ਹੋ ਗਈ ਕੋਚਿੰਗ ਜਾਂ ਫਿਰ ਕਿਸੇ ਹੋਰ ਦੀ ਸਹਾਇਤਾ ਤੋਂ ਬਿਨਾਂ ਵੀ ਸੁਸਾਇਟੀਆਂ ਵੀ ਸੁਸਾਇਟੀ ਦੀ ਜਿਹੜੀ ਆ ਤਾਅਨੇ ਨੇ ਉਹ ਵੀ ਜਿਹੜੇ ਹੈਗੇ ਆ ਇੱਕ ਅ ਡਾਂਸਰ ਲਈ ਬਹੁਤ ਹੀ ਜ਼ਿਆਦਾ ਮਤਲਬ ਸੰਗੀਨ ਹੁੰਦੇ ਨੇ ਅਤੇ ਇੱਕ ਡਾਂਸਰ ਨੂੰ ਬਹੁਤ ਹੀ ਜ਼ਿਆਦਾ ਡੀਮੋਟੀਵੇਟ ਕਰ ਦਿੰਦੇ ਨੇ ਅਤੇ ਉਸ ਤੋਂ ਇਲਾਵਾ ਸਾਡੇ ਪਿੰਡ ਇੱਕ ਬਹੁਤ ਹੀ ਪਛੜਿਆ ਪਿੰਡ ਹੈ ਅਤੇ ਇਹਦੇ ਕਰਕੇ ਜਿਹੜੀ ਲੋਕਾਂ ਦੀ ਸੋਚ ਹੈ ਉਹ ਵੀ ਜ਼ਿਆਦਾ ਉਭਰੀ ਹੋਈ ਨਹੀਂ ਹੈ ਜਾਂ ਫਿਰ ਜਿਹੜੀ ਸੋਚ ਹੈ ਉਹ ਬਹੁਤ ਹੀ ਛੋਟੀ ਸੋਚ ਹੈ ਜਿਹਦੇ ਕਰਕੇ ਕਈ ਤਰ੍ਹਾਂ ਦੀਆਂ ਮੁਸ਼ਕਿਲਾਂ ਦਾ ਸਾਹਮਣਾ ਜਿਹੜੇ ਇੱਕ ਡਾਂਸਰ ਨੂੰ ਕਰਨਾ ਪੈਂਦਾ ਹੈ